ਸਿਲਾਈ ਅਤੇ ਬੁਣਾਈ ਦੇ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਟੂਲਸ ਹੁੰਦੇ ਹਨ ਜਿਵੇਂ ਬੁਣਾ ਬੁਣਾਈ ਦੇ ਲਈ ਆਪਾਂ ਸਿਲਾਈਆਂ ਦਾ ਯੂਜ ਕਰਦੇ ਹਾਂ ਕਰੋਸ਼ੀਆ ਹੁੰਦਾ ਵਾ ਜੋ ਉੱਨ ਹੁੰਦੀ ਆ ਉਹਦੇ ਨਾਲ ਨਾ ਆਪਾਂ ਬੁਣਦੇ ਹਾਂ ਅਤੇ ਇੱਕ ਉੱਨ ਹੋ ਗਈ ਇਸ ਤਰ੍ਹਾਂ ਹੀ ਜਿਹੜੀ ਆਪਾਂ ਸਿਲਾਈ ਆ ਸਿਲਾਈ ਦੇ ਲਈ ਵੀ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਟੂਲਸ ਹੁੰਦੇ ਆ ਜਿਵੇਂ ਕਿ ਸਿਲਾਈ ਮਸ਼ੀਨ ਹੋ ਗਈ ਫਿਰਕੀ ਹੋ ਗਈ ਆਪਣੀਆਂ ਰੀਲਾਂ ਹੋ ਗਈਆਂ ਇਸ ਇਸ ਤਰ੍ਹਾਂ ਦੋਵਾਂ ਦੇ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਟੂਲਸ ਹੈਗੇ ਆ ਇਹਨਾਂ ਦੋਵਾਂ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਇੰਟਰਸਟ ਆ ਜਿਵੇਂ ਕਿ ਸਿਲਾਈ ਸਿਲਾਈ ਮੈਨੂੰ ਫੈਸ਼ਨ ਡਿਜ਼ਾਇਨਿੰਗ ਦਾ ਵੀ ਚਾਅ ਹੈਗਾ ਵਾ ਇਸ ਲਈ ਮੈਂ ਸਿਲਾਈ ਦੇ ਲਈ ਹੋਰ ਵੀ ਮਸ਼ੀਨਾਂ ਯੂਜ ਕਰਨਾ ਚਾਹੁੰਦੀ ਹਾਂ ਆਪਣੀਆਂ ਕਢਾਈ ਕਰਨ ਵਾਲੀਆਂ ਮਸ਼ੀਨਾਂ ਲੈ ਕੇ ਆਉਣਾ ਚਾਹੁੰਦੀ ਹਾਂ ਜਿਹਦੇ ਨਾਲ ਕਿ ਜਿਹੜਾ ਮੇਰੇ ਸੂਟ ਆ ਉਹ ਹੋਰ ਸੋਹਣੇ ਦਿਖਣ ਬਹੁਤ ਸਭ ਨੂੰ ਜ਼ਿਆਦਾਤਰ ਸਭ ਨੂੰ ਹੀ ਮੇਰੇ ਜਿਹੜੇ ਸੂਟ ਆ ਮੇਰੇ ਹੱਥ ਦੇ ਬਣਾਏ ਹੋਏ ਸੂਟਸ ਡਿਜ਼ਾਇਨਸ ਪਸੰਦ ਆਉਂਦੇ ਆ ਸਭ ਨੂੰ ਜਿਹੜੇ ਮੇਰੇ ਬਣਾਏ ਹੋਏ ਸੂਟ ਅਤੇ ਫਿਟਿੰਗ ਆ ਉਹ ਵੀ ਬਹੁਤ ਸਾਰੀ ਵਧੀਆ ਆਉਂਦੀ ਆ ਆਪਾਂ ਸਿਲਾਈ ਅਤੇ ਬੁਣਾਈ ਦੇ ਵਿੱਚ ਦੋਵਾਂ ਦੇ ਵਿੱਚ ਬਟਨਸ ਦਾ ਵੀ ਯੂਜ ਕਰਦੇ ਹੈਗੇ ਹਾਂ ਜਿਹੜੇ ਹੈਗੇ ਆਪਣੇ ਬੁਣਾਈ ਦੇ ਵਿੱਚ ਆਪਾਂ ਕਾਜ ਕੱਢਦੇ ਹਾਂ ਆਪਣੀ ਸਵੈਟਰਸ 'ਤੇ ਕੋਟੀਆਂ 'ਤੇ ਉਹਨਾਂ ਦੇ ਵਿੱਚ ਆਪਾਂ ਬਟਨ ਯੂਜ ਕਰਦੇ ਹਾਂ ਅਤੇ ਜਿਹੜੇ ਆਪਣੇ ਸੂਟਸ ਆ ਉਹਨਾਂ 'ਤੇ ਵੀ ਆਪਾਂ ਡਿਫਰੈਂਟ ਡਿਫਰੈਂਟ ਬਟਨ ਦੇ ਨਾਲ ਡਿਜ਼ਾਇਨਿੰਗ ਕਰਦੇ ਹਾਂ ਆਪਾਂ ਟਿੱਚ ਬਟਨਸ ਦਾ ਯੂਜ ਕਰਦੇ ਹਾਂ ਜੋ ਕਿ ਆਪਾਂ ਨੂੰ ਬਹੁਤ ਹੈਲਪ ਕਰਦੇ ਆ ਫਿਰ ਆਪਾਂ ਜਿਹੜੇ ਸੂਟਸ ਆ ਉਹਨਾਂ 'ਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਲੇਸਿਸ ਵੀ ਯੂਜ ਕਰਦੇ ਆਪਾਂ ਲੇਸਿਸ ਦੇ ਨਾਲ ਡਿਜ਼ਾਇਨਿੰਗ ਕਰਦੇ ਹਾਂ ਆਪਾਂ ਧਾਗੇ ਦੀ ਥਰੈਡ ਦੀ ਕਢਾਈ ਵੀ ਕਰਵਾਉਂਦੇ ਹਾਂ ਆਪਾਂ ਤਿੱਲੇ ਦੀ ਕਢਾਈ ਕਰਵਾ ਲੈਂਦੇ ਹਾਂ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਡਿਜ਼ਾਇਨਸ ਆਪਾਂ ਕਰਦੇ ਹਾਂ ਜੋ ਕਿ ਕਢਾਈ ਮਸ਼ੀਨ ਦੇ ਨਾਲ ਕੀਤੇ ਜਾਂਦੇ ਆ ਫਿਰ ਇੱਕ ਇੰਟਰਲੋਕ ਮਸ਼ੀਨ ਹੁੰਦੀ ਆ ਜਿਹੜੀ ਕਿ ਆਪਾਂ ਸੂਟਾਂ ਦੇ ਜਿਹੜੇ ਧਾਗੇ ਨਿਕਲਦੇ ਆ ਉਹ ਬੰਦ ਕਰਨ ਦੇ ਲਈ ਆਪਾਂ ਯੂਜ ਕਰਦੇ ਹਾਂ ਫਿਰ ਚੁੰਨੀਆਂ ਦੇ ਉੱਪਰ ਵੀ ਆਪਾਂ ਪੀਕੋ ਦਾ ਯੂਜ ਕਰਦੇ ਹਾਂ ਚੁੰਨੀ ਦੇ ਉੱਪਰ ਆਪਾਂ ਫਿਰ ਲੈਸ ਵੀ ਲਗਾ ਲੈਦੇ ਹਾਂ ਸੂਟ ਦੀ ਡਿਜ਼ਾਇਨ ਕਰਨ ਦੇ ਲਈ ਉਹਨੂੰ ਹੋਰ ਸੋਹਣਾ ਬਣਾਉਣ ਦੇ ਲਈ ਮੇਰੇ ਸਾਰੇ ਫਰੈਂਡਸ ਰਿਲੇਟਿਵਸ ਜ਼ਿਆਦਾਤਰ ਮੇਰੇ ਤੋਂ ਹੀ ਸੂਟ ਸਟਿੱਚ ਕਰਵਾਉਂਦੇ ਆ ਕਿਉਂਕਿ ਉਹਨਾਂ ਨੂੰ ਮੇਰੀ ਸੂਟਸ ਬਣਾਏ ਹੋਏ ਨੇ ਉਹਨਾਂ ਦੀ ਫਿਟਿੰਗ ਬਹੁਤ ਵਧੀਆ ਆਉਂਦੀ ਹੈ ਅਤੇ ਉਹਨਾਂ ਨੂੰ ਸਾਰੇ ਡਿਜ਼ਾਇਨਸ ਵੀ ਬਹੁਤ ਜ਼ਿਆਦਾ ਪਸੰਦ ਆਉਂਦੇ ਆ ਅਤੇ ਮੈਂ ਆਪਣੇ ਖੁਦ ਦੇ ਸੂਟ ਵੀ ਖੁਦ ਆਪ ਹੀ ਡਿਜ਼ਾਇਨ ਕਰਦੀ ਹਾਂ ਆਪਣੇ ਹੱਥ ਦੇ ਬਣਾਏ ਹੋਏ ਸੂਟ ਹੀ ਮੈਨੂੰ ਪਸੰਦ ਆ